ਮੈਂ ਤੁਹਾਨੂੰ ਭੰਗੜੇ ਬਾਰੇ ਦੱਸਣ ਜਾ ਰਹੀ ਹਾਂ ਭੰਗੜਾ ਇੱਕ ਅਜਿਹਾ ਨਾਚ ਹੈ ਜੋ ਕਿ ਜੋਸ਼ ਅਤੇ ਫੁਰਤੀ ਨਾਲ ਮਸ਼ਹੂਰ ਹੈ ਇਹ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਹੈ ਇਸ ਨੂੰ ਗੱਭਰੂ ਬੜੇ ਹੀ ਉਤਸ਼ਾਹ ਖੁਸ਼ੀ ਨਾਲ ਪਾਉਂਦੇ ਹਨ ਭੰਗੜਾ ਇੱਕ ਅਜਿਹੀ ਖੁਸ਼ੀ ਹੈ ਜੋ ਆਪਾਂ ਨੂੰ ਖੁਸ਼ੀ ਪ੍ਰਗਟਾਉਣ ਦਾ ਲੋਕ ਨਾਚ ਹੈ ਇਹ ਹਰੇਕ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂਦਾ ਹੈ ਜਿਵੇਂ ਕਿ ਉਹ ਕੋਈ ਤਿਉਹਾਰ ਹੋਵੇ ਜਾਂ ਕੋਈ ਵਿਆਹ ਸ਼ਾਦੀ ਹੋਵੇ ਜਾਂ ਕੋਈ ਨਵ ਜੰਮੇ ਬੱਚੇ ਦੀ ਖੁਸ਼ੀ ਦਾ ਖੁਸ਼ੀ ਮਨਾਉਣ ਦਾ ਕੋਈ ਮੌਕਾ ਹੋਵੇ ਇਸ ਨਾਲ ਭੰਗੜਾ ਪਾਉਣ ਵਾਲੇ ਦੇ ਅੰਦਰ ਇੱਕ ਅਲੱਗ ਹੀ ਖੁਸ਼ੀ ਅਤੇ ਰਚਨਾਤਮਕ ਭਾਵ ਪੈਦਾ ਹੁੰਦੇ ਹਨ ਇਹ ਸਰੀਰ ਦੀ ਤੰਦਰੁਸਤ ਰੱਖਣ ਵਿੱਚ ਹੀ ਅਹਿਮ ਭੂਮਿਕਾ ਨਿਭਾਉਂਦਾ ਹੈ ਇਸ ਨਾਲ ਸਰੀਰ ਸਦਾ ਗਤੀ ਕਰਦਾ ਹੈ ਸਾਡੇ ਹੱਥ ਪੈਰ ਲੱਤਾਂ ਬਾਂਹਵਾਂ ਹਿਲਦੀਆਂ ਰਹਿੰਦੀਆਂ ਹਨ ਜਿਸ ਨਾਲ ਖੂਨ ਪ੍ਰਸਾਰਨ ਹੀ ਸਹੀ ਤਰੀਕੇ ਨਾਲ ਹੁੰਦਾ ਹੈ ਪੰਜਾਬੀ ਸਿੱਖਣ ਲਈ ਇਹ ਨਾਚ ਇੱਕ ਕਲਾ ਕਲਾਦਰ ਅਤੇ ਧਰਮ ਦਾ ਪ੍ਰਤੀਕ ਹੈ ਇਹ ਮਨੁੱਖੀ ਦਿਮਾਗ ਨੂੰ ਵੀ ਕਾਫੀ ਫਾਇਦੇ ਦਿੰਦਾ ਹੈ ਜਿਸ ਨਾਲ ਉਸ ਦੀ ਸਰੀਰਿਕ ਗਤੀ ਅਤੇ ਦਿਮਾਗੀ ਗਤੀ ਬਹੁਤ ਤੇਜ਼ੀ ਨਾਲ ਵਿਕਸਿਤ ਹੁੰਦੀ ਹੈ ਭੰਗੜਾ ਇੱਕ ਅਲੱਗ ਲੋਕ ਨਾਚ ਹੈ ਜੋ ਕਿ ਖੁਸ਼ੀ ਅਤੇ ਸਿਹਤ ਲਈ ਦਾ ਚੰਗਾ ਸ ਸੰਕੇਤ ਹੈ